ਅ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਇਥੋਂ ਸਰਹੰਦ ਤੋਂ ਬੋਲ ਰਹੀ ਹਾਂ ਮੇਰੇ ਬੱਚਿਆਂ ਨੇ ਅੱਜ ਤੁਹਾਡੇ ਰੈਸਟੋਰੈਂਟ ਤੋਂ ਸਵੇਰੇ ਇੱਕ ਔਡਰ ਮੰਗਾਇਆ ਸੀ ਜਿਸ ਦੇ ਵਿੱਚ ਕਿ ਉਹਨਾਂ ਨੇ ਬਰਗਰਸ ਦਾ ਔਡਰ ਦਿੱਤਾ ਸੀ ਇਹ ਜਿਹੜੇ ਬਰਗਰ ਤੁਸੀਂ ਭੇਜੇ ਹਨ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਵਾਸੇ ਹਨ ਇਸ ਦੇ ਵਿੱਚੋਂ ਸਮੈਲ ਆ ਰਹੀ ਹੈ ਇਹ ਜਾਂ ਤਾਂ ਤੁਸੀਂ ਪਹਿਲਾਂ ਬਣਾਏ ਹੋਏ ਹਨ ਜਾਂ ਤੁਸੀਂ ਇਹਦੇ ਵਿੱਚ ਜਿਹੜਾ ਸਮਾਨ ਵਰਤਿਆ ਹੈ ਇਹਨਾਂ ਨੂੰ ਬਣਾਉਣ ਦੇ ਵਾਸਤੇ ਉਹ ਐਕਸਪਾਇਰ ਹੋ ਚੁੱਕਿਆ ਹੈ ਉਸ ਦੀ ਤਰੀਕ ਲੰਘ ਚੁੱਕੀ ਹੈ ਇਸੇ ਕਰਕੇ ਇਹ ਜਿਹੜੇ ਬਰਗਰ ਨੇ ਇਹ ਖਰਾਬ ਹਨ ਮੈਂ ਤੁਹਾਨੂੰ ਇਸ ਦੇ ਬਾਰੇ 'ਚ ਸ਼ਿਕਾਇਤ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਰੈਸਟੋਰੈਂਟ ਦਾ ਜੇ ਨਾਮ ਚੰਗਾ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੇ ਕੋਈ ਵੀ ਅੱਗੇ ਤੋਂ ਕੰਮ ਨਾ ਕਰੋ ਤਾਂ ਕਿ